ਹਾਂਜੀ ਮੈਂ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਸਕੂਲ ਦੇ ਵਿੱਚ ਬੱਚਿਆਂ ਦੇ ਸਿਲੇਬਸ ਵਿੱਚ ਕਰਜ਼ੇ ਅਤੇ ਰਿਟਰਨ ਬਾਰੇ ਜਿਹੜਾ ਉਹ ਦੱਸਿਆ ਜਾਵੇ ਕਿਉਂਕਿ ਜਿਵੇਂ ਕਿ ਮੈਂ ਤੁਹਾਨੂੰ ਇੱਕ ਕੰਪਨੀ ਬਾਰੇ ਦੱਸ ਰਹੀ ਹਾਂ ਕਿ ਗੋਲਡ ਲੋਨ ਦੇ ਵਿੱਚ ਆਪਾਂ ਜਦੋਂ ਗੋਲਡ ਲੋਨ ਲੈਂਦੇ ਹੈ ਤਾਂ ਉਹਦੇ ਵਿੱਚ ਕਿਆ ਕਰਦੇ ਹੈ ਤਾਂ ਕੰਪਨੀ ਸਾਨੂੰ ਦੱਸ ਦਿੰਦੀ ਹੈ ਕਿ ਤੁਹਾਡੇ ਤੀਹ ਦਿਨਾਂ ਦਾ ਤੁਹਾਨੂੰ ਇੰਨਾ ਵਿਆਜ ਪੈਣਾ ਹੈ ਪਰ ਉਹ ਪ ਇਹ ਨਹੀਂ ਦੱਸਦੀ ਕਿ ਜੇ ਅਗਰ ਉਹ ਪੈਂਤੀ ਦਿਨ ਤੋਂ ਉੱਪਰ ਟੱਪਦਾ ਹੈ ਤਾਂ ਜਿਹੜੀ ਆਰ ਓ ਆਈ ਹੈ ਉਹ ਜੰਪ ਕਰ ਜਾਂਦੀ ਹੈ ਇਸ ਕਰਕੇ ਜਿਹੜਾ ਵੱਧ ਤੋਂ ਵੱਧ ਜਿਹੜਾ ਵਿਆਜ ਪਈ ਜਾਂਦਾ ਹੈ ਬੰਦੇ ਨੂੰ ਉਹਨੇ ਆਪਣੀ ਚੀਜ਼ ਤਾਂ ਕਿਆ ਛਡਵਾਉਣੀ ਹੈ ਜਿਹੜਾ ਉਹਦੇ 'ਤੇ ਐਨਾ ਵਿਆਜ ਲੱਗ ਜਾਂਦਾ ਹੈ ਕਿ ਉਹ ਵਿਆਜ ਵੀ ਭਰਨ ਦੇ ਕਾਬਲ ਨਹੀਂ ਹੁੰਦਾ ਇਸ ਕਰਕੇ ਜੇ ਬੱਚਿਆਂ ਨੂੰ ਇਹ ਚੀਜ਼ਾਂ ਸਕੂਲਾਂ ਦੇ ਵਿੱਚ ਸਿਲੇਬਸ ਦੇ ਵਿੱਚ ਦੱਸੀਆਂ ਜਾਣ ਕਿ ਉਹ ਜਿਹੜਾ ਹੈ ਕਿ ਕਿੰਨੇ ਟਾਈਮ ਦੇ ਵਿੱਚ ਕਿੰਨੇ ਟਾਈਮ 'ਚ ਉਹਨਾਂ ਨੇ ਆਪਣਾ ਵਿਆਜ ਭਰਨਾ ਹੈ ਕਿੰਨਾ ਉਹਨਾਂ ਦਾ ਜਿਹੜਾ ਪੈਸਾ ਉਹਨਾਂ ਨੇ ਲਿਆ ਸੀ ਉਹਦੇ ਉੱਪਰ ਕਿੰਨਾ ਵਿਆਜ ਬਣ ਰਿਹਾ ਹੈ ਜੇ ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਪੂਰਾ ਪਤਾ ਹੋਵੇ ਤਾਂ ਉਹ ਕਦੇ ਵੀ ਸਹੀ ਤਰੀਕੇ ਨਾਲ ਜਿਹੜਾ ਉਹ ਲੋਨ ਲੈ ਸਕਦੇ ਹੈ ਉਹਨਾਂ ਨੂੰ ਕਿਸੇ ਤਰਾਂ ਦੀ ਦਿੱਕਤ ਨਹੀਂ ਆ ਸਕਦੀ ਕਿੰਨੇ ਟਾਈਮ ਦੇ ਵਿੱਚ ਉਹਨਾਂ ਨੇ ਉਹਨਾਂ ਚੀਜ਼ਾਂ ਨੂੰ ਵਾਪਸ ਕਰਨਾ ਹੈ ਰਿਟਰਨ ਕਰਨਾ ਹੈ ਇਸ ਚੀਜ਼ ਬਾਰੇ ਵੀ ਉਹਨਾਂ ਨੂੰ ਜਿਹੜੀ ਹੈ ਉਹ ਪੂਰੀ ਨੌਲੇਜ ਹੋਣੀ ਚਾਹੀਦੀ ਹੈ ਇਸ ਕਰਕੇ ਮੈਂ ਚਾਹੁੰਦੀ ਹਾਂ ਕਿ ਇਹ ਜਿਹੜੀਆਂ ਚੀਜ਼ਾਂ ਇਹ ਬੱਚਿਆਂ ਦੇ ਸਿਲੇਬਸ ਦੇ ਵਿੱਚ ਜਰੂਰੀਆਂ ਹੋਣੀ ਚਾਹੀਦੀਆਂ ਹਨ